ਮੇਰੇ ਖੇਤਰ ਵਿੱਚ ਬਹੁਤ ਹੀ ਭਿੰਨ ਭਿੰਨ ਪ੍ਰਕਾਰ ਦੇ ਪੰਛੀ ਹਨ ਜਿਵੇਂ ਕਿ ਚਿੜੀਆਂ ਕਾਂ ਮੋਰ ਅਤੇ ਤੋਤੇ ਅਤੇ ਮੇਰਾ ਪਸੰਦੀਦਾ ਪਕਸ਼ੀ ਮੋਰ ਹੈ ਕਿਉਂਕਿ ਮੈਨੂੰ ਉਸ ਦਾ ਪੈਲ ਪਾਉਣ ਵਾਲਾ ਦ੍ਰਿਸ਼ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਅਤੇ ਨਾਲ ਹੀ ਨਾਲ ਮੈਨੂੰ ਕਬੂਤਰਾਂ ਨੂੰ ਚੋਗਾ ਪਾਉਣਾ ਵੀ ਬਹੁਤ ਹੀ ਜ਼ਿਆਦਾ ਪਸੰਦ ਹੈ ਅਤੇ ਨਾਲ ਹੀ ਨਾਲ ਮੈਂ ਆਪਣੇ ਕੋਠੇ ਉੱਪਰ ਕਬੂਤਰ ਵੀ ਰੱਖੇ ਹੋਏ ਹਨ